ਮੈਂ ਬਹੁਤ ਟਾਈਮ ਪਹਿਲਾਂ ਇੱਕ ਪੇਂਟਿੰਗ ਬਣਾਈ ਸੀ ਜਿਹਦੇ ਵਿੱਚ ਹਰਿਆਲੀ ਅਤੇ ਝਰਨਾ ਵਹਿ ਰਿਹਾ ਸੀ ਅਤੇ ਨਾਲ ਉੱਥੇ ਕੁੜੀਆਂ ਉਸ ਸੁਹਾਨੇ ਮੌਸਮ ਨੂੰ ਇੰਜੋਏ ਕਰ ਰਹੀਆਂ ਸਨ ਮੈਂ ਇਹੀ ਪੇਂਟਿੰਗ ਦੇ ਵਿੱਚ ਕਦਮ ਰੱਖਣਾ ਚਾਹਾਂਗੀ ਤਾਂ ਕਿ ਮੈਂ ਉਸ ਵਿਊ ਅਤੇ ਉਸ ਆਜ਼ਾਦੀ ਭਰੇ ਆਜ਼ਾਦੀ ਭਰੇ ਮਾਹੌਲ ਨੂੰ ਮਹਿਸੂਸ ਕਰਾਂ ਜਿੱਥੇ ਮੈਨੂੰ ਕੋਈ ਵੀ ਰੋਕ ਟੋਕ ਅਤੇ ਪੁੱਛਣ ਵਾਲਾ ਨਾ ਹੋਵੇ ਅਤੇ ਮੈਂ ਫਰੀਲੀ ਟੈਂਸ਼ਨ ਫਰੀ ਹੋ ਕੇ ਕੁਝ ਸਮਾਂ ਉੱਥੇ ਬਤੀਤ ਕਰ ਸਕਾਂ ਅਤੇ ਇਹ ਪੇਂਟਿੰਗ ਜਦੋਂ ਮੈਂ ਬਣਾਈ ਸੀ ਤਾਂ ਬਹੁਤ ਹੀ ਜ਼ਿਆਦਾ ਕੁੜੀਆਂ ਨੇ ਇਸ ਪੇਂਟਿੰਗ ਦੀ ਪ੍ਰਸ਼ੰਸਾ ਕੀਤੀ ਲੜਕੀਆਂ ਹੀ ਨੇ ਬਲਕਿ ਲੜਕਿਆਂ ਨੇ ਵੀ ਇਸ ਪੇਂਟਿੰਗ ਨੂੰ ਬਹੁਤ ਹੀ ਸਰਾਹਿਆ ਕਿਉਂਕਿ ਇਹ ਪੇਂਟਿੰਗ ਇੱਕ ਸ਼ਾਂਤ ਕਰਨ ਵਾਲੀ ਸੀ ਜਿਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿੱਦਾਂ ਕਿ ਸਾਰੀ ਦੁਨੀਆਂ ਜਹਾਨ ਦੀ ਟੈਂਸ਼ਨ ਥਕਾਵਟ ਅਤੇ ਪੇ ਪਰੇਸ਼ਾਨੀਆਂ ਦੇਖ ਇਸ ਪੇਂਟਿੰਗ ਨੂੰ ਦੇਖਣ ਸਾਰ ਹੀ ਮਿਟ ਜਾਂਦੀਆਂ ਸਨ ਅਤੇ ਇੰਝ ਲੱਗਦਾ ਸੀ ਕਿ ਅਸੀਂ ਕਿਸੇ ਹੋਰ ਹੀ ਜਹਾਨ ਦੁਨੀਆਂ 'ਤੇ ਆ ਗਏ ਹਾਂ ਇਹ ਅਤੇ ਉਸ ਸੋਹਣੇ ਜਿਹੇ ਮੌਸਮ ਦੇ ਵਿੱਚ ਇੰਜੋਏ ਕਰ ਰਹੇ ਹਾਂ ਇਹ ਪੇਂਟਿੰਗ ਮੈਨੂੰ ਮੇਰੀ ਸਭ ਤੋਂ ਪਿਆਰੀ ਪੇਂਟਿੰਗ ਲੱਗੀ ਜਿਸ ਨੂੰ ਮੈਂ ਖੁਦ ਵੀ ਬਹੁਤ ਹੀ ਪਿਆਰ ਰ ਕਰਦੀ ਹਾਂ ਅਤੇ ਇਹ ਪੇਂਟਿੰਗ ਮੈਨੇ ਆਪਣੇ ਕਮਰੇ ਦੇ ਵਿੱਚ ਲਗਾਈ ਹੋਈ ਹੈ ਜਦੋਂ ਵੀ ਮੈਨੂੰ ਕੋਈ ਵੀ ਪਰੇਸ਼ਾਨੀ ਜਾਂ ਟੈਂਸ਼ਨ ਮਹਿਸੂਸ ਹੁੰਦੀ ਤਾਂ ਮੈਂ ਇਸ ਪੇਂਟਿੰਗ ਨੂੰ ਦੇਖਣਾ ਪ੍ਰੈਫਰ ਕਰਦੀ ਹਾਂ ਤਾਂ ਜੋ ਮੈਨੂੰ ਕੁਝ ਸਮੇਂ ਲਈ ਬਾਹਰੀ ਚੀਜ਼ਾਂ ਤੋਂ ਸ਼ਾਂਤੀ ਮਿਲ ਸਕੇ